ਛੱਬੀ ਅਪ੍ਰੈਲ ਦੋ ਹਜ਼ਾਰ ਤਿੰਨ ਦਸ ਫਰਵਰੀ ਉੱਨੀ ਸੌ ਤ੍ਰਿਆਸੀ ਵੀਹ ਮਾਰਚ ਉੱਨੀ ਸੋ ਛਿਹੱਤਰ ਪੰਦਰਾ ਜੂਨ ਦੋ ਹਜ਼ਾਰ ਤਿੰਨ ਉੱਨੀ ਜੁਲਾਈ ਦੋ ਹਜ਼ਾਰ ਤਿੰਨ